ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਤੇਜਪਾਲਜੀਤ ਸਿੰਘ ਆ ਅਤੇ ਸਾਡੇ ਅੰਮ੍ਰਿਤਸਰ ਵਿੱਚ ਬਹੁਤ ਜੇ ਮੁੱਖ ਵਿੱਦਿਅਕ ਅਦਾਰੇ ਹੈਗੇ ਆ ਜਿੱਥੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਉਹਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਆ ਜਿੱਦਾਂ ਕਿ ਕਈ ਸਕੂਲ ਯੂਨੀਵਰਸਿਟੀ ਕਾਲਜ ਪੂਰੇ ਅੰਮ੍ਰਿਤਸਰ ਵਿੱਚ ਹੈਗੇ ਹਾ ਸੌ ਤੋਂ ਉੱਪਰ ਹੀ ਆ ਜਿੱਦਾਂ ਕਿ ਹੈਗੇ ਆ ਪੋਲੀਟੈਕਨਿਕਲ ਕੋਲਜ ਕੀ ਕਹਿੰਦੇ ਆ ਗੁਰੂ ਰਾਮਦਾਸ ਸਕੂਲ ਖਾਲਸਾ ਕੋਲਜ ਅਤੇ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਈ ਕੇ ਗੁਜਰਾਲ ਯੂਨੀਵਰਸਿਟੀ ਇਹੋ ਜਿਹੇ ਬਹੁਤ ਵੱਡੇ ਵੱਡੇ ਅਦਾਰੇ ਹੈਗੇ ਆ ਜਿਨ੍ਹਾਂ' ਤੇ ਪੜ੍ਹਾਇਆ ਜਾਂਦਾ ਵਾ ਮੈਡੀਕਲ ਕੋਲਜ ਕਈ ਹੈਗੇ ਆ ਜਿੱਥੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਵਾ ਇੱਥੇ ਬੱਚਿਆਂ ਨੂੰ ਬਹੁਤ ਘੱਟ ਖਰਚੇ ਵਿੱਚ ਪੜ੍ਹਾਇਆ ਜਾਂਦਾ ਵਾ ਜੋ ਕਿ ਸਾਡੇ ਲਈ ਬਹੁਤ ਵਧੀਆ ਹੈ ਇੱਥੇ ਅਨੁਸੂਚਿਤ ਜਾਤੀਆਂ ਵਾਲੇ ਬੱਚਿਆਂ ਨੂੰ ਮੁਫਤ ਸਿਖਲਾਈ ਦਿੱਤੀ ਜਾਂਦੀ ਹਰ ਤਰ੍ਹਾਂ ਦੀ ਪੜ੍ਹਾਈ ਦਿੱਤੀ ਜਾਂਦੀ ਹੈ ਜੋ ਕਿ ਇਹਨਾਂ ਨੂੰ ਅੱਗੇ ਵਧਣ ਵਿੱਚ ਮਦਦ ਕਰਦੀ ਹੈ ਅਤੇ ਨਵੇਂ ਨਵੇਂ ਉਤਪਾਦ ਨਵੇਂ ਨਵੇਂ ਹੋਰ ਵੀ ਨਵੇਂ ਨਵੇਂ ਕਿੱਤੇ ਖੋਲਣ ਵਿੱਚ ਇਹਨਾਂ ਨੂੰ ਮਦਦ ਕਰਦੀ ਹੈ ਅਤੇ ਇਸ ਅਦਾਰਿਆ ਵਿੱਚ ਬੱਚਾ ਪੜ੍ਹ ਕੇ ਆਪਣਾ ਬਹੁਤ ਵਧੀਆ ਇੱਕ ਭਵਿੱਖ ਬਣਾ ਸਕਦਾ ਹੈ ਇਸ ਲਈ ਅਮ੍ਰਿਤਸਰ ਜਿਲ੍ਹੇ ਵਿੱਚ ਹੋਰ ਵੀ ਕਈ ਡੀ ਏ ਵੀ ਕੋਲਜ ਵਰਗੇ ਵੱਡੇ ਵੱਡੇ ਯੂਨੀਵਰਸਿਟੀਆਂ ਕੋਲਜ ਹਨ ਜਿੱਥੇ ਬੱਚਾ ਪੜ੍ਹ ਕੇ ਬਹੁਤ ਵਧੀਆ ਤਰੱਕੀ ਕਰਦਾ ਹੈ ਸੋ ਸਾਨੂੰ ਹੁਣ ਸਾਨੂੰ ਸਭ ਨੂੰ ਪੜ੍ਹਨਾ ਚਾਹੀਦਾ ਹੈ ਸਾਡੇ ਵਧੀਆ ਭਵਿੱਖ ਲਈ ਅਤੇ ਸਾਡਾ ਅੰਮ੍ਰਿਤਸਰ ਸ਼ਹਿਰ ਵੀ ਇਸ ਕਰਕੇ ਹੀ ਬਹੁਤ ਮਸ਼ਹੂਰ ਹੈ ਕਿਉਂਕਿ ਇੱਥੇ ਬਹੁਤ ਵਧੀਆ ਵਧੀਆ ਅਦਾਰੇ ਹਨ ਜਿਥੇ ਬੱਚਾ ਪੜ੍ਹ ਸਕਦਾ ਹੈ ਅਤੇ ਵਧੀਆ ਆਪਣਾ ਭਵਿੱਖ ਬਣਾ ਸਕਦਾ ਹੈ ਸੋ ਅੰਮ੍ਰਿਤਸਰ ਜਿਹੜਾ ਇਸ ਕਰਕੇ ਮਸ਼ਹੂਰ ਹੈ ਧੰਨਵਾਦ